ਟੈਕਨੋਲਜੀ ਅਤੇ ਇੰਟਰਨੈਟ ਦੇ ਆਗਮਨ ਨਾਲ ਪੰਜਾਬੀ ਭਾਸ਼ਾ ਦੀ ਵਰਤੋਂ ਵਿੱਚ ਕਈ ਤਰੀਕਿਆਂ ਵਿੱਚ ਬਦਲਾਵ ਆਏ ਡਿਜੀਟਲ ਪਲੇਟਫਾਰਮ ਦਾ ਪ੍ਰਸਾਰ ਪੰਜਾਬੀ ਭਾਸ਼ਾ ਦਾ ਵਿਕਾਸ ਕਈ ਡਿਜੀਟਲ ਪਲੇਟਫਾਰਮ ਤੇ ਹੋਇਆ ਹੈ ਯੂਟਿਊਬ ਫੇਸਬੁੱਕ ਟਵੀਟਰ ਅਤੇ ਇਸਟਾਗ੍ਰਾਮ ਵਰਗੀਆਂ ਸਾਈਟਾਂ ਤੇ ਪੰਜਾਬੀ ਵਿੱਚ ਸਮੱਗਰੀ ਬਣਾਉਣ ਅਤੇ ਸ਼ੇਅਰ ਕਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ ਮੋਬਾਈਲ ਐਪਸ ਮੋਬਾਈਲ ਐਪਲੀਕੇਸ਼ਨਾਂ ਦੇ ਰਾਹੀਂ ਪੰਜਾਬੀ ਦੀ ਵਰਤੋਂ ਵੱਧ ਰਹੀ ਹੈ ਪੰਜਾਬੀ ਖਬਰਾਂ ਕਹਾਣੀਆਂ ਸਿੱਖਿਆ ਸਮੱਗਰੀ ਮਨੋਰੰਜਨ ਐਪ ਸੋ ਉਪਲਬਧ ਹਨ ਪੰਜਾਬੀ ਭਾਸ਼ਾ ਵਿੱਚ ਬਹੁਤ ਸਾਈਕ ਕੁਨੈਕਟ ਕਈ ਵੈਬਸਾਈਟਾਂ ਨੇ ਆਪਣੀ ਸਮੱਗਰੀ ਨੂੰ ਕਈ ਭਾਸ਼ਾਵਾਂ ਵਿੱਚ ਉਪਲਬਧ ਕਰਵਾਇਆ ਹੈ ਜਿਸ ਵਿੱਚ ਪੰਜਾਬੀ ਵੀ ਸ਼ਾਮਿਲ ਹੈ ਇਸ ਵਿੱਚ ਪੰਜਾਬੀ ਬੋਲਣ ਵਾਲੇ ਉਪਭੋਗਤਾ ਲਈ ਇੰਟਰਨੈਟ ਤੇ ਪਹੁੰਚ ਸੌਖੀ ਹੋ ਗਈ ਪੰਜਾਬੀ ਟਾਈਪਿੰਗ ਅਤੇ ਸਧਾਰਨ ਇੰਟਰਨੈਟ ਟੈਕਨੋਲਜੀ ਪੰਜਾਬੀ ਟਾਈਪਿੰਗ ਸਿੱਖਣਾ ਵਰਤਣਾ ਆਸਾਨ ਬਣਾਉਣਾ ਗੂਗਲ ਇਨਪੁੱਟ ਟੂਲ ਪੰਜਾਬੀ ਟਾਈਪਿੰਗ ਸੋਫਟਵੇਅਰ ਅਤੇ ਵਾਈਸ ਟੂ ਵਰਗੇ ਸਾਧਨ ਬਹੁਤ ਮਦਦਗਾਰ ਸਾਬਿਤ ਹੋਏ ਹਨ ਸ਼ਬਦ ਕੋਸ ਅਤੇ ਅਨੁਵਾਦ ਲਈ ਅਨ ਔਨਲਾਈਨ ਸ਼ਬਦਕੋਸ਼ ਅਨੁਵਾਰ ਸੇਵਾਵਾਂ ਉਪਲਬਧ ਹਨ ਸੋ ਪੰਜਾਬੀ ਵਿਚਾਰਤਾ ਲਈ ਪਾਠਕਾਂ ਲਈ ਬਹੁਤ ਫਾਇਦੇਮੰਦ ਹਨ ਪੰਜਾਬੀ ਭਾਸ਼ਾ ਵੱਧ ਰਿਹਾ ਹੈ ਕਈ ਔਨਲਾਈਨ ਕੋਰਸ ਅਤੇ ਪੰਜਾਬੀ ਵਿੱਚ ਉਪਲੱਬਧ ਹਨ ਜੋ ਸਿੱਖਿਆ ਨੂੰ ਆਸਾਨ ਬਣਾ ਰਹੇ ਹਨ